ਕੈਬ ਮੈਨੂੰ ਮੇਰੀ ਮੰਜ਼ਿਲ ਤੱਕ ਕਿੰਨੇ ਸਮੇਂ ਵਿੱਚ ਪਹੁੰਚਾਏਗੀ ਨਵਾਂ ਰਸਤਾ ਲੈਣ ਕਾਰਨ ਮੈਨੂੰ ਕੋਈ ਦੇਰੀ ਤਾਂ ਨਹੀਂ ਹੋਵੇਗੀ ਅਗਰ ਮੈਨੂੰ ਕੋਈ ਦੇਰੀ ਹੋਵੇਗੀ ਤਾਂ ਫਿਰ ਕਿੰਨਾ ਸਮਾਂ ਲੱਗੇਗਾ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਿੰਨੀ ਕੁ ਦੇਰੀ ਹੋ ਸਕਦੀ ਹੈ